ਮੇਰੀ ਸਥਾਨਕ ਭਾਸ਼ਾ ਦੇ ਵਿੱਚ ਇੱਕ ਯੂਟੀਊਬ ਚੈਨਲ ਹੈ ਜਿਸਦਾ ਨਾਮ ਹੈ ਜੱਟ ਬੀਟ ਰਿਕੋਡ ਜਿਹਦੇ ਉੱਤੇ ਜਿਹੜੀ ਮੂਵੀਜ਼ ਨੇ ਉਹ ਕੀਤੀਆਂ ਜਾਂਦੀਆਂ ਨੇ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਅਤੇ ਅਸੀਂ ਜਿਹੜੀ ਮੈਂ ਮੂਵੀਜ਼ ਆ ਉੱਥੋਂ ਹੀ ਦੇਖਦੀ ਹਾਂ ਅਤੇ ਮੇਰਾ ਇੱਕ ਅਤੇ ਫੇਵਰੇਟ ਜਿਹੜਾ ਹੈਗਾ ਕਾਰਟੂਨ ਟੀ ਵੀ ਪ੍ਰੋਗਰਾਮ ਹੈ ਉਹਦਾ ਨਾਮ ਹੈ ਹੈਪੀ ਸ਼ੇਰੂ ਐਂਡ ਬਿੱਲੂ ਅਤੇ ਉੱਥੇ ਜਿਹੜਾ ਹੈਗਾ ਬੜਾ ਹੀ ਚੰਗਾ ਹੁੰਦਾ ਅਤੇ ਮਤਲਬ ਉਹ ਜਿਹੜੀ ਹੈਗੀ ਆ ਮੂਵੀਜ਼ ਹੈਗੀਆਂ ਨੇ ਉਹਨਾਂ ਦੇ ਜਦੋਂ ਮਸ਼ਹੂਰੀਆਂ ਆਉਂਦੀਆਂ ਨੇ ਅਤੇ ਉਹਨਾਂ ਦੇ ਵਿੱਚ ਹੀ ਕੁਛ ਟਾਈਮ ਲਈ ਜਿਹੜਾ ਹੈਗਾ ਉਹ ਪ੍ਰੋਗਰਾਮ ਜਿਹੜਾ ਹੈਗਾ ਦਿਖਾਇਆ ਜਾਂਦਾ ਐੱਮ ਐੱਚ ਵਨ ਟੀ ਵੀ 'ਤੇ ਅਤੇ ਮੈਨੂੰ ਬੜਾ ਚੰਗਾ ਲੱਗਦਾ ਮੇਰੇ ਲਈ ਲੱਗਦਾ ਕਿ ਬਹੁਤ ਜ਼ਿਆਦਾ ਮਤਲਬ ਹਾਸ ਰਸ ਜਿਹਾ ਪ੍ਰੋਗਰਾਮ ਹੈ ਉਹ ਅਤੇ ਮੈਨੂੰ ਜਿਹੜਾ ਹੈਗਾ ਉਸ ਤੋਂ ਇਲਾਵਾ ਆਪਣੀ ਸਥਾਨਕ ਭਾਸ਼ਾ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਤਰ੍ਹਾਂ ਦੇ ਚੈਨਲ ਨੇ ਜਿਹੜੀ ਦੂਜੀਆਂ ਭਾਸ਼ਾਵਾਂ ਦੇ ਵਿੱਚ ਨੇ ਮੈਂ ਉਹਨਾਂ ਨੂੰ ਦੇਖਣਾ ਪਸੰਦ ਕਰਦੀ ਹਾਂ ਜਿਵੇਂ ਇੱਕ ਬਿਗ ਹਿੱਟ ਐਟਰਟੇਨਮੈਂਟ ਇੱਕ ਚੈਨਲ ਹੈ ਜਿਹਦੇ ਉੱਤੇ ਇੱਕ ਬੀ ਟੀ ਐੱਸ ਨਾਮ ਦਾ ਗਰੁੱਪ ਹੈ ਉਹਦੇ ਜਿਹੜੀਆਂ ਡਾਂਸਿੰਗ ਵੀਡੀਓਜ਼ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਸੌਂਗਸ ਨੇ ਉਹ ਪਾਏ ਜਾਂਦੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਹੁੰਦੇ ਨੇ ਅਤੇ ਮੈਨੂੰ ਬੜਾ ਚੰਗਾ ਲੱਗਦਾ ਉਹਨਾਂ ਦੇ ਸੌਂਗ ਸੁਣ ਕੇ ਅਤੇ ਜਿਹੜੀਆਂ ਆਪਣੀਆਂ ਸਥਾਨਕ ਭਾਸ਼ਾ ਦੇ ਹੋਰ ਵੀ ਕਈ ਯੂਟੀਊਬ ਚੈਨਲਸ ਜਿਹਨਾਂ ਦਾ ਫੋਲੋ ਕਰਦੀ ਹਾਂ ਜਿਨ੍ਹਾਂ ਤੋਂ ਮੈਂ ਕਈ ਤਰ੍ਹਾਂ ਦੇ ਮਤਲਬ ਗਾਣੇ ਹੋ ਗਏ ਜਾਂ ਫਿਰ ਮੂਵੀਜ਼ ਹੋ ਗਈਆਂ ਜਾਂ ਕੋਈ ਕਾਰਟੂਨ ਪ੍ਰੋਗਰਾਮ ਹੋ ਗਿਆ ਜਾਂ ਫਿਰ ਕੋਈ ਮੋਟੀਵੇਸ਼ਨਲ ਦੇ ਨਾਲ ਰਿਲੇਟਡ ਕੋਈ ਵੀਡੀਓ ਹੋ ਗਈਆਂ ਉਹ ਆਉਂਦੀਆਂ ਨੇ ਅਤੇ ਕਈ ਵਾਰੀ ਮੈਂ ਆਪਣਾ ਜਿਹੜਾ ਹੈਗਾ ਕਿਉਂਕਿ ਮੈਂ ਪੰਜਾਬ ਦੇ ਵਿੱਚ ਪੜ੍ਹਦੀ ਹਾਂ ਅਤੇ ਮੇਰੇ ਜਿਹੜੇ ਹੈਗੇ ਐਜੂਕੇਸ਼ਨ ਦੇ ਨਾਲ ਅ ਸਬੰਧਿਤ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਹ ਵੀ ਮੈਂ ਦੇਖਦੀ ਹਾਂ ਅਤੇ ਮੈਂ ਨਿਊਜ਼ ਚੈਨਲ ਵੀ ਦੇਖਦੀ ਹਾਂ ਟੀ ਵੀ ਉੱਤੇ ਅਤੇ ਉਸ ਤੋਂ ਇਲਾਵਾ ਕਈ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਨੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਜਿਹੜਾ ਮੈਂ ਇਹਦੇ ਪ੍ਰੈਫਰ ਕਰਦੀ ਹਾਂ ਦੇਖਣਾ